ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਰਨਾਲਾ ਕਲੱਬ ਤੋਂ ਬੋਲਦੇ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਕਿੱਥੋਂ ਬੋਲਦੇ ਤੁਸੀਂ ਕਿੱਥੋਂ ਗੱਲ ਕਰਦੇ ਹੋ ਜੀ ਅੱਛਾ ਅੱਛਾ ਜੀ ਆਪਣੇ ਬੱਚੇ ਦੀ ਏਜ ਵਗੈਰਾ ਕੀ ਹੈ ਜੀ ਅੱਛਾ ਅੱਛਾ ਅੱਛਾ ਜੀ ਹਾਂਜੀ ਹਾਂਜੀ ਅੱਜ ਕੱਲ੍ਹ ਬੱਚੇ ਮੋਬਾਇਲ ਵਗੈਰਾ ਵੀ ਜ਼ਿਆਦਾ ਦੇਖਦੇ ਹੈ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਨਹੀਂ ਕੋਈ ਗੱਲ ਨਹੀਂ ਜੀ ਅਤੇ ਆਪਣੇ ਕੋਲ ਕਈ ਪ੍ਰਕਾਰ ਦੀਆਂ ਜਿਹੜੀਆਂ ਐਕਟੀਵੀਟੀਸ ਹੁੰਦੀਆਂ ਨੇ ਛੋਟੇ ਬੱਚਿਆਂ ਦੀ ਅਲੱਗ ਹੁੰਦੀਆਂ ਨੇ ਅਤੇ ਵੱਡਿਆਂ ਦੀ ਅਲੱਗ ਹੁੰਦੀਆਂ ਨੇ ਜਿਵੇਂ ਡਾਂਸ ਕਲਾਸਿਸ ਹੋ ਗਈਆਂ ਸਵੀਮਿੰਗ ਹੋ ਗਿਆ ਮਾਰਸ਼ਲ ਆਰਟਸ ਹੋ ਗਏ ਸਕੇਟਿੰਗ ਹੋ ਗਿਆ ਜੀ ਅਤੇ ਇਹ ਅਸੀਂ ਕਰਵਾਉਂਦੇ ਬੱਚਿਆਂ ਨੂੰ ਕਰਵਾਉਂਦੇ ਹਾਂ ਜੀ ਹੁਣ ਤੁਸੀਂ ਤੁਹਾਡੇ ਬੱਚੇ ਜਿਹੜਾ ਇੰਟਰਸਟ ਉਹ ਕਿਸ ਚੀਜ਼ ਦੇ ਵਿੱਚ ਹੈ ਜੀ ਉਸ ਤਰੀਕੇ ਨਾਲ ਫਿਰ ਅਸੀਂ ਉਸ ਦੀ ਐਕਟੀਵੀਟੀ ਉਹ ਦੇਖ ਸਕਦੇ ਹੈਗੇ ਹਾਂਜੀ ਹਾਂਜੀ ਹਾਂਜੀ ਹਾਂ ਨਹੀਂ ਠੀਕ ਹੈ ਮਾਰਸ਼ਲ ਆਰਟ ਦੀ ਕੁੜੀਆਂ ਬਹੁਤ ਸਾਡੇ ਕੋਲ ਆ ਰਹੀਆਂ ਨੇ ਕਾਫ਼ੀ ਹਾਂ ਉਹਨੂੰ ਡਾਂਸ ਡਾਂਸ ਕਲਾਸਸ 'ਚ ਪਾ ਦਿੰਦੇ ਡਾਂਸ ਕਲਾਸਸ ਵਿੱਚ ਪਾ ਦਿੰਦੇ ਹਾਂ ਜੀ ਹਾਂ ਹਾਂਜੀ

ਹਾਂਜੀ ਹਾਂ ਹਾਂਜੀ ਹਾਂ ਠੀਕ ਹੈ ਜੀ ਕਿਉਂਕਿ ਬੱਚਾ ਤੁਹਾਡਾ ਛੋਟਾ ਜੀ ਤੁਹਾਨੂੰ ਨਾ ਇੱਕ ਨਾਲ ਆਉਣਾ ਪਿਆ ਕਰੂਗਾ ਥੋੜ੍ਹਾ ਜਿਹਾ ਧਿਆਨ ਰੱਖਣਾ ਪਊਗਾ ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਸ਼ਰਾਰਤੀ ਹੁੰਦੇ ਨੇ ਜੀ ਕੋਈ ਸੱਟ ਫੇਟ ਵਗੈਰਾ ਖਾ ਲਵੇ ਹਾਂਜੀ ਹਾਂ ਟਾਇਮਿੰਗ ਵੈਸੇ ਸਾਡੀ ਵੀ ਓਪਨਲੀ ਛੇ ਤੋਂ ਛੇ ਹੁੰਦਾ ਜੀ ਬਾਕੀ ਆਪਣੇ ਬੱਚੇ ਕਿਸ ਟਾਇਮ ਫਰੀ ਹੁੰਦੇ ਨੇ ਜੀ ਠੀਕ ਹੈ ਫਿਰ ਤੁਸੀਂ ਹਾਂਜੀ ਚਾਰ ਚਾਰ ਹਾਂ ਚਾਰ ਤੋਂ ਪੰਜ ਦਾ ਰੱਖ ਲਓ ਚਾਰ ਤੋਂ ਪੰਜ ਦਾ ਰੱਖ ਲਓ ਜੀ

ਹਾਂਜੀ ਹਾਂਜੀ ਹਾਂ ਚਾਰ ਤੋਂ ਪੰਜ ਦਾ ਰੱਖ ਲਓ ਅਤੇ ਤੁਸੀਂ ਆਪਣੇ ਕੱਲ੍ਹ ਕੱਲ੍ਹ ਨੂੰ ਬੱਚਿਆਂ ਨੂੰ ਨਾਲ ਲਿਆਓ ਨਾਲੇ ਫਿਰ ਫੀਸ ਵਗੈਰਾ ਦੱਸ ਦੇਵਾਂਗੇ

ਵੈਸੇ ਤਾਂ ਅਸੀਂ ਛੋਟੇ ਬੱ ਛੋਟੇ ਛੋਟੇ ਬੱਚਿਆਂ ਦਾ ਅਸੀਂ ਹਜ਼ਾਰ ਰੁਪਈਆ ਲੈਂਦੇ ਹਾਂ ਜੀ ਅਤੇ ਗੁਡੀ ਹਾਂ ਜਿਵੇਂ ਮਾਰਸਲ ਆਰਟਸ ਵਗੈਰਾ ਦਾ ਅਸੀਂ ਪੰਦਰਾਂ ਸੌ ਲੈਂਦੇ ਰੱਖੇ ਹੋਏ ਹੈ ਜੀ ਮਾਸਟਰ ਟ੍ਰੇਨਰ ਰੱਖੇ ਹੋਏ ਸਾਡੇ ਕੋਲੇ ਹਾਂਜੀ ਹਾਂ ਬਾਕੀ ਕੋਈ ਗੱਲ ਨਹੀਂ ਮੌਕੇ 'ਤੇ ਕੁਛ ਨਾ ਕੁ ਕਰ ਲਾਂਗੇ ਹਾਂਜੀ ਹਾਂ ਨਹੀਂ ਕੋਈ ਗੱਲ ਨਹੀਂ ਕਰ ਲਾਂਗੇ ਤੁਸੀਂ ਆ ਜਿਓ ਇੱਕ ਵਾਰ ਆਪਾਂ ਕਰ ਲਾਂਗੇ ਅਡਜਸਟਮੈਂਟ ਹਾਂਜੀ ਹਾਂ